ਹੈਲੋ ਸਤਿ ਸ਼੍ਰੀ ਅਕਾਲ ਜੀ ਹਾਂਜੀ ਦੱਸੋ ਹਾਂਜੀ ਅੱਛਾ ਜੀ

ਇੱਕ ਮਹੀਨੇ ਦੀ ਦੱਸ ਹਜ਼ਾਰ ਲੈਂਦੇ ਹਾਂ ਜੀ ਅਸੀਂ ਫੀਸ

ਲੱਗਭਗ ਛੇ ਸਾਢੇ ਛੇ ਘੱਟੋ ਘੱਟ ਹਾਂਜੀ ਠੀਕ ਹੈ ਜੀ ਠੀਕ ਓਕੇ ਜੀ